ਹੈਲੋ ਹਾਂਜੀ ਹਾਂਜੀ ਹਾਂਜੀ ਤੁਸੀਂ ਕਿ ਕਿਸ ਗੇਮ ਦੇ ਵਿੱਚ ਰੱਖਣਾ ਚਾਹੁੰਦੇ ਹੋ ਆਪਣੇ ਬੱਚੇ ਨੂੰ ਹਾਂਜੀ ਅਛ ਅੱਛਾ ਜੀ ਕਿੰਨੇ ਸਾਲ ਦਾ ਬੱਚਾ ਤੁਹਾਡਾ ਅੱਛਾ ਜੀ ਅਤੇ ਸਾਡੇ ਕੋਲ ਜਿਵੇਂ ਬੱਚਿਆਂ ਦੀ ਐਕਟੀਵਿਟੀਜ ਹੈਗੀਆਂ ਨੇ ਫੁੱਟਬੋਲ ਹੋ ਗਈ ਲੁੱਡੋ ਹੋ ਗਈ ਅਤੇ ਜਿਵੇਂ ਡਰਾਇੰਗ ਵਗੈਰਾ ਹੋ ਗਈ ਅਤੇ ਬਾਸਕਿਟਬੋਲ ਹੋ ਗਈ ਕ੍ਰਿਕਟ ਵਗੈਰਾ ਹੋ ਗਿਆ ਇਹ ਸਾਡੇ ਕੋਲ ਗੇਮਜ਼ ਹੈਗੀਆਂ ਨੇ ਮਤਲਬ ਇਸ ਤੋਂ ਇਲਾਵਾ ਹੋਰ ਵੀ ਨੇ ਜਿਵੇਂ ਵੋਲੀਬੋਲ ਹੋ ਗਈ ਹਾਂਜੀ ਨਹੀਂ ਛੋਟੇ ਬੱਚੇ ਲਈ ਕੁਕਿੰਗ ਦਾ ਤਾਂ ਨਹੀਂ ਹੈ ਹਾਂਜੀ ਮਤਲਬ ਜਿਵੇਂ ਐਕਟੀਵਿਟੀਜ਼ ਵਾਲੀਆਂ ਹੀ ਗੇਮਜ਼ ਹੈਗੀਆਂ ਨੇ ਸਾਡੇ ਕੋਲ ਹਾਂਜੀ ਹਾਂਜੀ ਇਹਨਾਂ ਦੇ ਅਲੱਗ ਅਲੱਗ ਰੇਟ ਹੋਣਗੇ ਨਾ ਕੌਚ ਦੇ ਹਿਸਾਬ ਨਾਲ

ਹਾਂਜੀ ਟਾਈਮ ਤੁਸੀਂ ਲੈ ਸਕਦੇ ਹੋ ਇਵਨਿੰਗ ਮੋਰਨਿੰਗ ਆਫਟਰਨੂਨ ਕਦੇ ਵੀ ਲੈ ਸਕਦੇ ਹੋ ਹਾਂਜੀ ਜਿਵੇਂ ਦੋ ਹਜ਼ਾਰ ਤੋਂ ਤੁਸੀਂ ਸਟਾਰਟ ਕਰ ਲਓ ਦੋ ਹਜ਼ਾਰ ਗੇਮਜ਼ ਐਕਟੀਵਿਟੀਜ ਦੇ ਅਕੋਡਿੰਗ ਫਿਰ ਤੁਹਾਡੀ ਫੀਸ ਰੱਖਾਂਗੇ ਅਸੀਂ ਜਿਵੇਂ ਜਿਸ 'ਚ ਬੱਚੇ ਇੰਟਰਸਟ ਹੋਊਗਾ ਅਸੀਂ ਉਹ ਐਕਟੀਵਿਟੀ ਬੱਚੇ ਨੂੰ ਕਰਾਵਾਂਗੇ ਅਤੇ ਉਸ 'ਚ ਲੈ ਕੇ ਆਵਾਂਗੇ ਬੱਚੇ ਨੂੰ ਫਿਰ ਹਾਂਜੀ ਕੀ ਕਹਿੰਦੇ ਹੋ ਹਾਂਜੀ ਬਿਲਕੁਲ ਸੇਫਟੀ ਹੈਗੀ ਆ ਬੱਚੇ ਕੇਅਰ ਟੇਕਰ ਰੱਖੇ ਹੋਏ ਆ ਅਸੀਂ ਬੱਚਿਆਂ ਲਈ ਹਾਂਜੀ ਠੀਕ ਹੈ ਤੁਸੀਂ ਕੱਲ੍ਹ ਆਇਓ ਜ਼ਰੂਰ ਓਕੇ ਜੀ ਠੀਕ